ਹੈਲੋ ਹਾਂ ਜੀ ਸਰ ਮੈਂ ਮੋਹਿਤ ਕੌਸ਼ਲ ਬੋਲ ਰਿਹਾ ਜੀ ਪੰਜਾਬ ਮੀਡੀਆ ਤੋਂ ਸਤਿ ਸ਼੍ਰੀ ਅਕਾਲ ਸਰ ਮੈਂ ਤੁਹਾਡੇ ਸਮੇਂ ਦੇ ਵਿੱਚੋਂ ਚੰਦ ਮਿੰਟ ਲਵਾਗਾਂ ਥੋੜਾ ਜਿਹਾ ਤੁਹਾਡੇ ਇਲਾਕੇ ਦੇ ਬਾਰੇ ਜਾਣਕਾਰੀ ਲੈਣਾ ਚਾਹੁੰਦਾ ਜੀ ਕੀ ਇਹ ਸਮੇਂ ਕੀ ਇਹ ਸਮੇਂ ਤੁਹਾਡੇ ਨਾਲ ਗੱਲ ਕਰਨ ਲਈ ਸਹੀ ਹੈ ਜੀ ਸਰ ਤੁਹਾਡੇ ਇਲਾਕੇ ਦੇ ਵਿੱਚ ਇੱਥੇ ਏਅਰਪੋਰਟ ਬਣਿਆ ਹੈਗਾ ਹੈ ਨਵਾਂ ਅਤੇ ਮੈਂ ਇਹ ਜਾਣਨਾ ਚਾਹੁੰਦਾ ਕਿ ਤੁਹਾਡੇ ਕੀ ਵਿਚਾਰ ਹੈ ਤੁਹਾਡੇ ਇਲਾਕੇ ਨੂੰ ਏਅਰਪੋਰਟ ਬਣਨ ਨਾਲ ਕਿੰਨੀ ਕੁ ਡਿਵਲਪਮੈਂਟ ਤੁਹਾਡੇ ਏਰੀਏ ਦੇ ਵਿੱਚ ਹੋਈ ਹੈ ਅਤੇ ਤੁਹਾਨੂੰ ਉਸਦਾ ਕੀ ਫਾਈਦਾ ਹੋਇਆ ਹੈ ਨਿੱਜੀ ਜੀਵਨ ਉੱਤੇ ਅਤੇ ਇਸ ਦੇ ਉੱਤੇ ਥੋੜਾ ਜਿਹਾ ਚਾਨਣ ਪਾਉ ਜੀ ਹਾਂ ਠੀਕ ਹੈ ਜੀ ਜਿਵੇਂ ਕੀ ਸਰ ਜਿਵੇਂ ਕੀ ਤੁਹਾਡੇ ਨਿੱਜੀ ਜੀਵਨ ਉੱਤੇ ਅੱਛਾ ਜੀ ਅੱਛਾ ਜੀ ਅੱਛਾ ਜੀ ਸਰ ਅਤੇ ਜੇ ਜਿਵੇਂ ਆਮ ਦੁਕਾਨਦਾਰਾਂ ਦੀ ਗੱਲ ਕਰਾ ਜੀ ਏਅਰਪੋਰਟ ਦੇ ਨਾਲ ਜਿਵੇਂ ਕਿਸੇ ਦਾ ਹੋਟਲ ਹੈ ਤਾਂ ਦੁਕਾਨਾਂ 'ਤੇ ਵੀ ਅਸਰ ਪਿਆ ਹੈ ਇਸਦਾ ਕੁਝ ਠੀਕ ਹੈ ਜੀ ਠੀਕ ਹੈ ਬਿਲਕੁੱਲ ਸਰ ਮੈਂ ਇੱਕ ਆਰਟੀਕਲ ਲਿਖ ਰਿਹਾ ਸੀ ਇਸਦੇ ਉੱਤੇ ਤਾਂਕਿ ਮੈਨੂੰ ਜਿਹੜੀ ਵੀ ਜਾਣਕਾਰੀ ਮੈਂ ਕਿਹਾ ਜਿਹੜਾ ਇੱਕ ਆਮ ਨਾਗਰਿਕ ਹੈ ਉਸਤੋਂ ਲੈ ਲਾ ਤਾਂਕਿ ਲੋਕ ਉਸ ਆਰਟੀਕਲ ਦੇ ਵਿੱਚ ਸਾਡੀ ਮੱਦਦ ਹੋ ਸਕੇ ਕਿਉਂਕਿ ਤੁਸੀਂ ਆਪ ਉਸਦੇ ਨਿੱਜੀ ਜੀਵਨ ਦੇ ਵਿੱਚ ਉਸਦੇ ਵਿੱਚ ਵਿਚਰ ਰਹੇ ਹੋ ਤਾਂ ਤੁਹਾਡੇ ਤੋਂ ਵਧੀਆ ਸਾਨੂੰ ਜਿਹੜੀ ਇਸ ਵਧਦੀ ਡਿ ਡਿਵਲਪਮੈਂਟ ਦੀ ਜਾਣਕਾਰੀ ਕੋਈ ਹੋਰ ਨਹੀਂ ਦੇ ਸਕੇਗਾ ਤਾਂ ਤੁਸੀਂ ਕੋਈ ਕੁੱਝ ਹੋਰ ਵਿਚਾਰ ਸਾਂਝਾ ਕਰਨਾ ਚਾਹੁੰਦੇ ਹੋ ਜੋ ਕੀ ਤੁਹਾਡੇ ਧਿਆਨ ਦੇ ਵਿੱਚ ਹੋਵੇ ਇਸਤੋਂ ਇਲਾਵਾ ਕੀ ਹੋਰ ਉਸਦਾ ਤੁਹਾਡੇ ਹੂੰ ਅੱਛਾ ਜੀ ਠੀਕ ਹੈ ਜੀ ਸਰ ਬਹੁਤ ਇਹ ਬਹੁਤ ਵੈਲਿਡ ਪੁਆਇੰਟ ਹੈ ਕੀ ਬੰਦੇ ਨੂੰ ਪਰੋਪਰ ਇੱਕ ਸਾਧਨ ਦਾ ਉਪਯੋਗ ਕਰ ਸਕੇ ਚਲੋ ਸਰ ਮੈਂ ਇਹ ਵੀ ਆਪਣੇ ਆਰਟੀਕਲ ਦੇ ਵਿੱਚ ਲਿਖਾਗਾਂ ਇਹ ਵੀ ਤੋਹਾਡੀਆਂ ਲਾਈਨਾਂ 'ਤੇ ਧੰਨਵਾਦ ਸਰ ਤੁਹਾਡਾ ਕੀਮਤੀ ਸਮਾਂ ਲੈਣ ਵਾਸਤੇ ਮੋਹਿਤ ਕੌਸ਼ਲ ਨਵਾਂ ਪੰਜਾਬ ਜੀ